ਪੰਜਾਬੀ ਦਾ ਪ੍ਰਭਾਵਿਤ ਪੰਜਾਬੀ ਨੂੰ ਪ੍ਰਭਾਵਿਤ ਹੋਣ ਦਾ ਸਭ ਤੋਂ ਵੱਡਾ ਹਿੱਸਾ ਜਿਹੜਾ ਸਾਡਾ ਬੱਚੇ ਅੱਜ ਕੱਲ੍ਹ ਦੇ ਉਹ ਪੰਜਾਬੀ ਬੋਲ ਕੇ ਰਾਜ਼ੀ ਨਹੀਂ ਆਪਣੀ ਮਾਤ ਭਾਸ਼ਾ ਨੂੰ ਛੱਡ ਛੱਡ ਕੇ ਜਿੱਦਾਂ ਹੁਣ ਜਿਵੇਂ ਤੁਸੀਂ ਦੇਖ ਲਉ ਵੀ ਕਿਸੇ ਮੋਲ 'ਚ ਜਾਈਦਾ ਉੱਥੇ ਸਭ ਤੋਂ ਪਹਿਲਾਂ ਮੂਹਰੇ ਰਿਸੈਪਸ਼ਨ 'ਤੇ ਜੋ ਹੁੰਦਾ ਉਹ ਪਹਿਲਾਂ ਹਿੰਦੀ ਬੋਲਦਾ ਆਪ ਕਹਾਂ ਜਾ ਕਿਆ ਚਾਹੀਏ ਕਹਾਂ ਜਾਓਗੇ ਚਲੋ ਫਿਰ ਚਲੋ ਉਹ ਤਾਂ ਬਾਹਰ ਦੇ ਆਪਣੇ ਘਰ ਦੇ ਵਿੱਚ ਲਾ ਲਈਦਾ ਹੁਣ ਬੱਚ ਕਿਉਂਕਿ ਸਕੂਲਾਂ ਦੇ ਜ ਵਿੱਚ ਜਿਹੜੀ ਪੜ੍ਹਾਈ ਵੀ ਉਹ ਪੰਜਾਬੀ ਨੂੰ ਪਿੱਛੇ ਰੱਖਿਆ ਹੋਇਆ ਆਪਣੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਇੰਗਲਿਸ਼ ਮੀਡੀਅਮ ਫਲਾਣਾ ਢਿਮਕਾ ਅਮਕਾ ਜਦੋਂ ਜਾਏ ਪ ਘਰ ਪੁੱਛੀਦਾ ਆਪਣੇ ਭਾਸ਼ਾ ਦੇ ਵਿੱਚ ਆਪਾਂ ਜਿਵੇਂ ਪੁਰਾਣੇ ਬਜ਼ੁਰਗ ਆ ਆਪਣੇ ਆਪੇ ਉਹੀ ਬੋਲਣੀ ਆ ਪੰਜਾਬੀ ਓ ਸ਼ੁੱਧ ਪੰਜਾਬੀ ਬੋਲਦਾ ਵੀ ਭਾਈ ਸੱਤ ਸੌ ਸਤਾਈ ਲਿਖੋ ਤਾਂ ਬੱਚੇ ਪਤਾ ਕੀ ਕਹਿਣਗੇ ਜੇ ਕੋਈ ਮੋਬਾਇਲ ਨੰਬਰ ਵੀ ਬੋਲਣਾ ਨਹੀਂ ਪਾਪਾ ਵਨ ਟੂ ਰਾਹੀਂ ਦੱਸੋ ਸਮਝ ਨਹੀਂ ਲੱਗਦੀ ਇਸ ਕਰਕੇ ਤਾਂ ਦੂਜਾ ਇਹਦਾ ਮੇਨ ਕਾਰਨ ਕੀ ਆ ਚਲੋ ਇਹਦਾ ਪੜ੍ਹਾਈ ਹੋ ਗਈ ਬੱ ਬੱਸਾਂ ਨੇ ਹੁਣ ਸਾਰੇ ਬੱਸਾਂ ਨੇ ਉਹਨਾਂ ਦੇ ਉੱਪਰ ਜਿਹੜੇ ਬੋਰਡ ਨੇ ਪਟਿਆਲਾ ਟੂ ਅੰਮ੍ਰਿਤਸਰ ਜਦਕਿ ਪੰਜਾਬ ਤੋਂ ਪੰਜਾਬ 'ਚ ਜਾਣੀ ਆ ਬਸ ਉਹ ਉਹਦੇ 'ਤੇ ਵੀ ਇੰਗਲਿਸ਼ 'ਚ ਲਿਖੀ ਹੋਈ ਆ ਅਤੇ ਕਿਸੇ ਵੀ ਸ਼ੋਪਿੰਗ ਮੋਲ 'ਤੇ ਚਲੇ ਜਾਉ ਉੱਥੇ ਵੀ ਲਿਖਿਆ ਹੋਊਗਾ ਇੰਗਲਿਸ਼ ਦੇ ਵਿੱਚ ਲਿਖਿਆ ਹੋਊਗਾ ਸਾਈਨ ਬੋਰਡ ਈਵਨ ਕਿ ਸਾਈਨ ਬੋਰਡ ਜਿਹੜੇ ਲੱਗੇ ਆ ਜਗ੍ਹਾ ਜਗ੍ਹਾ 'ਤੇ ਉਹਦੇ 'ਤੇ ਵੀ ਜੇ ਕਿਤੇ ਪੰਜਾਬੀ ਲਿਖੀ ਵੀ ਆ ਕਿਤੇ ਤਾਂ ਸਭ ਤੋਂ ਨੀਚੇ ਉੱਪਰ ਲਿਖਿਆ ਹੁੰਦਾ ਇੰਗਲਿਸ਼ ਥੱਲੇ ਹਿੰਦੀ ਉੁਸ ਤਾਂ ਸਭ ਤੋਂ ਨੀਚੇ ਪੰਜਾਬੀ ਜਿਹਨੇ ਉੱਪਰ ਪੜ੍ਹ ਲਿਆ ਜਾਂ ਵਿਚਾਲੇ ਪੜ੍ਹ ਲਉ ਤੁਸੀਂ ਨੀਚੇ ਵਾਲੇ ਨੂੰ ਪੜ੍ਹਦੇ ਨਹੀਂ ਇ ਇਸ ਤਰ੍ਹਾਂ ਸਾਡੀ ਪੰਜਾਬੀ ਭਾਸ਼ਾ ਪ੍ਰਭਾਵਿਤ ਹੋਈ ਹੈ